ਮੇਰੇ ਕੋਲ ਕੁੜਤੀਆਂ ਨਹੀਂ ਸੀ ਅਤੇ ਗਰਮੀਆਂ ਵੀ ਬਹੁਤ ਆ ਗਈਆਂ ਸੀ ਤਾਂ ਮੈਂ ਸੋਚਿਆ ਕੁਝ ਕੱਪੜੇ ਖਰੀਦ ਲਵਾਂ ਅਤੇ ਮੈਂ ਰੋਪੜ ਗਈ ਪਰੰਤੂ ਉੱਥੇ ਮੈਨੂੰ ਕੁਝ ਵੀ ਪਸੰਦ ਨਹੀਂ ਆਇਆ ਫਿਰ ਮੈਂ ਸੋਚਿਆ ਕੁਝ ਔਨਲਾਈਨ ਵੇਖਾਂ ਅਤੇ ਮੈਂ ਮੰਤਰਾ ਤੋਂ ਕੁਝ ਕੁੜਤੀਆਂ ਦੇਖੀਆਂ ਅਤੇ ਬਹੁਤ ਸੋਹਣੀਆਂ ਸੀ ਪਰੰਤੂ ਮੈਨੂੰ ਡਰ ਵੀ ਸੀ ਕਿ ਕੁਝ ਭੈੜੀਆਂ ਨਾ ਨਿਕਲਣ ਪਰੰਤੂ ਫਿਰ ਮੈਂ ਸੋਚ ਸੋਚ ਕੇ ਇੱਕ ਆਰਡਰ ਕਰ ਦਿੱਤਾ ਅਤੇ ਉਹ ਕੁੜਤੀਆਂ ਮੇਰੇ ਬਜਟ ਦੀ ਵੀ ਹੈ ਸੀ ਅਤੇ ਕਲਰ ਵੀ ਬਹੁਤ ਸੋਹਣਾ ਸੀ ਇਸ ਲਈ ਫਿਰ ਮੈਂ ਆਰਡਰ ਪਲੇਸ ਕਰ ਦਿੱਤਾ ਅਤੇ ਜਦੋਂ ਆਰਡਰ ਆਇਆ ਅਤੇ ਮੈਨੂੰ ਡਰ ਵੀ ਸੀ ਕੀ ਕੱਪੜਾ ਕਿਤੇ ਖਰਾਬ ਨਾ ਨਿਕਲੇ ਫਿਰ ਮੈਂ ਉਹ ਜਦੋਂ ਖੋਲ੍ਹਿਆ ਤਾਂ ਉਹ ਕੁੜਤੀ ਬਹੁਤ ਸੋਹਣੀ ਸੀ ਕੱਪੜਾ ਵੀ ਸਟੱਫ ਬਿਲਕੁਲ ਵਧੀਆ ਅਤੇ ਜਦੋਂ ਮੈਂ ਪਾ ਕੇ ਦੇਖਿਆ ਬਿਲਕੁਲ ਮੇਰੇ ਸਾਈਜ਼ ਦਾ ਅਤੇ ਸਾਰੇ ਬਹੁਤ ਖੁਸ਼ ਹੋਏ ਕਿ ਹਾਂ ਤੂੰ ਤਾਂ ਬਹੁਤ ਵਧੀਆ ਸ਼ੋਪਿੰਗ ਕਰ ਲੈਂਦੀ ਹੈਂ ਸਮਾਰਟ ਹੋ ਗਈ ਹੈਂ ਅਤੇ ਫੇਰ ਜਦੋਂ ਮੈਂ ਆਫਿਸ ਪਾ ਕੇ ਗਈ ਤਾਂ ਸਾਰੇ ਮੇਰੇ ਕੂਲੀਗਸ ਨੇ ਕਿਹਾ ਕਿ ਹਾਂ ਬਹੁਤ ਸੁੰਦਰ ਲੱਗ ਰਹੀ ਹੈ ਕੁੜਤੀ ਕਿੱਥੋਂ ਲਈ ਹੈ ਅਤੇ ਫਿਰ ਜਦੋਂ ਮੈਂ ਦੱਸਿਆ ਕਿ ਹਾਂ ਇਹ ਤਾਂ ਮੈਂ ਆਨਲਾਈਨ ਮੰਗਵਾਈ ਹੈ ਅਤੇ ਮੰਤਰਾ ਤੋਂ ਮੰਗਵਾਈ ਹੈ ਅਤੇ ਬਜਟ ਵੀ ਬਹੁਤ ਸਸਤਾ ਹੈ ਠੀਕ ਹੈ ਅਫੋਰਡੇਬਲ ਹੈ ਅਤੇ ਮੈਂ ਉਹਨਾਂ ਨੂੰ ਦੱਸਿਆ ਅਤੇ ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ ਹੀ ਨਹੀਂ ਕੀਤਾ ਕਿ ਹਾਂ ਇੰਨੀ ਸਸਤੀ ਮਿਲ ਸਕਦੀ ਹੈ ਤੈਨੂੰ ਪਰ ਫਿਰ ਮੈਂ ਉਹਨਾਂ ਨੂੰ ਦਿਖਾਇਆ ਕਿ ਨਹੀਂ ਹਾਂ ਇੱਦਾਂ ਅਵੇਲੇਬਲ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਲਈ ਵੀ ਮੰਗਵਾ ਦੀ ਅਤੇ ਸਭ ਨੇ ਬਹੁਤ ਤਾਰੀਫ ਕੀਤੀ ਮੇਰਾ ਵੀ ਸ਼ੋਪਿੰਗ ਐਕਪੀਰੀਐਂਸ ਬਹੁਤ ਅੱਛਾ ਰਿਹਾ ਇਸ ਦੇ ਨਾਲ ਹਾਂ ਮੈਂ ਹੁਣ ਹੋਰ ਵੀ ਕੁੜਤੀਜ਼ ਮੰਗਵਾਉਣ ਬਾਰੇ ਸੋਚ ਰਹੀ ਹਾਂ ਅਤੇ ਹੋਰ ਮੇਰੇ ਫਰੈਂਡਸ ਵੀ